ਹੈਲੋ ਨਟਰਾਜ ਸ਼ੋ ਮੈਂ ਪਰਮਿੰਦਰ ਰੋਪੜ ਤੋਂ ਬੋਲ ਰਿਹਾਂ ਸੋ ਮੇਰੀ ਧੀ ਦਾ ਵਿਆਹ ਹੈ ਦੋ ਦਿਨ ਬਾਅਦ ਸ ਇਹਦੇ ਲਈ ਮੈਂ ਤੁਹਾਨੂੰ ਫ਼ੋਨ ਕੀਤਾ ਹੈ ਮਿਠਾਈ ਵਾਸਤੇ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਿਠਾਈ ਪਹਿਲਾਂ ਮੈਨੂੰ ਦੱਸੋ ਕਿ ਕਿਹੜੀ ਕਿਹੜੀ ਮਿਠਾਈ ਹੈ ਅਤੇ ਉਸ ਤੋਂ ਬਾਅਦ ਫਿਰ ਮੈਂ ਔਰਡਰ ਬੁੱਕ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਾਡਾ ਜਿਹੜੀ ਸਾਡੀ ਲੋੜ ਹੈ ਲੱਡੂ ਸਾਨੂੰ ਚਾਹੀਦੇ ਹੈ ਸ਼ਗਨ ਲਈ ਅਤੇ ਤੁਸੀਂ ਪਲੀਸ ਫਰੈਸ਼ ਲੱਡੂ ਦਾ ਔਰਡਰ ਬੁੱਕ ਕਰ ਲਉ ਆਈ ਥਿੰਕ ਦਸ ਕਿਲੋ ਲੱਡੂ ਬਹੁਤ ਹੋਣਗੇ ਅਤੇ ਉਸ ਤੋਂ ਬਾਅਦ ਹੋਰ ਮਿਠਾਈਆਂ ਜੋ ਕਿ ਅਸੀਂ ਘਰ ਵਾਸਤੇ ਸਾਨੂੰ ਗੈਸਟ ਲਈ ਸਰਵ ਕਰਨੀਆਂ ਜਿੱਦਾਂ ਬਰਫੀ ਹੋ ਗਈ ਸ਼ੱਕਰਪਾਰੇ ਹੋ ਗਏ ਅਤੇ ਇਹ ਤੁਸੀਂ ਪੰਜ ਪੰਜ ਕਿਲੋ ਲਿਖ ਲਉ ਉਸ ਤੋਂ ਬਾਅਦ ਸਾਡੇ ਸੌ ਕੁ ਮਹਿਮਾਨ ਆਉਣਗੇ ਉਹਨਾਂ ਲਈ ਸਾਨੂੰ ਇੱਕ ਡੱਬੇ ਇੱਕ ਇੱਕ ਡੱਬਾ ਫਰੈਸ਼ ਮਿਠਾਈ ਮਿਕਸ ਮਿਠਾਈ ਹੋ ਜੇ ਦਾ ਤਾਂ ਇਸ ਮਤਲਬ ਵੀ ਅੱਛਾ ਹੈ ਅਤੇ ਉਸ ਤੋਂ ਬਾਅਦ ਤੁਸੀ ਤੁਸੀ ਐਡਰੈੱਸ ਮੇਰਾ ਨੋਟ ਕਰ ਲਉ ਇਸ ਐਡਰੈੱਸ 'ਤੇ ਤੁਸੀ ਮੈਨੂੰ ਸੈਂਡ ਕਰ ਦਿਉ ਮੇਰਾ ਐਡਰੈੱਸ ਹੈ ਹਾਊਸ ਨੰਬਰ ਦੋ ਸੌ ਤੇਰਾਂ ਗਿਆਨੀ ਜ਼ੈਲ ਸਿੰਘ ਨਗਰ ਅਤੇ ਕੋਸ਼ਿਸ਼ ਕਰਿਓ ਕਿ ਮਿਠਾਈ ਟਾਈਮ ਸਿਰ ਪਹੁੰਚੇ ਕਿਉਂਕਿ ਲੇਟ ਫਿਰ ਸਾਡਾ ਪ੍ਰੋਗਰਾਮ ਰਹਿ ਜਾਣਾ ਜੀ ਸਾਨੂੰ ਕਿਉਂਕਿ ਲੱਡੂ ਸਾਨੂੰ ਚਾਹੀਦੇ ਹੈ ਫੰਕਸ਼ਨ ਵਾਸਤੇ ਇਸ ਕਰਕੇ ਤੁਸੀ ਮਿਠਾਈ ਸਾਨੂੰ ਜਲਦੀ ਭੇਜੋ ਔਰ ਧਿਆਨ ਰੱਖਣਾ ਜਿਹੜੀ ਮਿਠਾਈ ਫਰੇਸ਼ ਹੋਵੇ ਹਾਇਜੇਨਿਕ ਹੋਵੇ ਵੀ ਕਿਉਂਕਿ ਸਾਨੂੰ ਬਾਅਦ ਵਿੱਚ ਕਿਉਂਕਿ ਸਾਡੇ ਜਿਹੜੇ ਰਿਸ਼ਤੇਦਾਰ ਆ ਬਹੁਤ ਕਲੋਜ਼ ਹੈ ਬ ਅਤੇ ਸਾਨੂੰ ਬਾਅਦ 'ਚੋਂ ਅਲਾਂਭਾ ਨਹੀਂ ਆਉਣਾ ਚਾਹੀਦਾ ਵੀ ਤੁਹਾਡੀ ਮਿਠਾਈ ਚੰਗੀ ਨਹੀਂ ਸੀ ਵਧੀਆ ਨਹੀਂ ਸੀ ਅਤੇ ਸਾਨੂੰ ਵਧੀਆ ਨਹੀਂ ਲੱਗੀ ਅਤੇ ਰਿਕਵੈਸਟ ਹੈ ਵੀ ਮਿਠਾਈ ਤੁਸੀ ਆਪ ਅੱਛੀ ਤਰ੍ਹਾਂ ਪੈਕ ਕਰਵਾਉਣੀ ਹੈ ਪੈਕਿੰਗ ਕਰਨੀ ਹੈ ਅਤੇ ਇਸ ਐਡਰੈੱਸ 'ਤੇ ਭੇਜ ਦੇਣੀ ਹੈ